ਰਾਸ਼ਟਰੀ ਪਾਰਕ ਇੱਕ ਅਜਿਹਾ ਖੇਤਰ ਹੈ ਜੋ ਸਰਕਾਰ ਦੁਆਰਾ ਬਨਸਪਤੀ ਅਤੇ ਜੀਵ ਜੰਤੂਆਂ ਦੀ ਸੰਭਾਲ ਲਈ ਦਿੱਤਾ ਗਿਆ ਹੈ ਰਾਸ਼ਟਰੀ ਪਾਰਕ ਮਨੋਰੰਜਨ ਅਤੇ ਮਨੋਰੰਜਨ ਦੇ ਉਦੇਸ਼ ਲਈ ਲੋਕਾਂ ਦੀ ਵਰਤੋਂ ਵਿੱਚ ਆਉਂਦਾ ਹੈ ਰਾਸ਼ਟਰੀ ਪਾਰਕਾਂ ਵਿੱਚ ਜ਼ਿਆਦਾਤਰ ਲੈਂਡਸਕੇਪ ਅਤੇ ਉਹਨਾਂ ਦੇ ਨਾਲ ਮੌਜੂਦ ਬਨਸਪਤੀ ਅਤੇ ਜੀਵ ਜੰਤੂ ਉਹਨਾਂ ਦੀ ਕੁਦਰਤੀ ਸਥਿਤੀ ਵਿੱਚ ਸੁਰੱਖਿਅਤ ਹਨ ਵੱਖ ਵੱਖ ਦੇਸ਼ਾਂ ਵਿੱਚ ਕਈ ਰਾਸ਼ਟਰੀ ਪਾਰਕ ਹਨ ਜੋ ਆਪਣੇ ਸ੍ਰੋਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਬਹੁਤ ਭਿੰਨ ਹੁੰਦੇ ਹਨ ਸਰਕਾਰਾਂ ਨਿਯਮਾਂ ਨੂੰ ਸਖਤੀ ਨਾਲ਼ ਲਾਗੂ ਕਰਨ ਨੂੰ ਸੰਭਵ ਬਣਾਉਣ ਲਈ ਬਹੁਤ ਵੱਡਾ ਬਜਟ ਪੇਸ਼ ਕਰਦੀਆਂ ਹਨ ਦੂਸਰੇ ਨਹੀਂ ਕਰਦੇ ਰਾਸ਼ਟਰੀ ਪਾਰਕ ਨਾ ਸਿਰਫ ਬਨਸਪਤੀ ਅਤੇ ਜੀਵ ਜੰਤੂਆਂ ਨੂੰ ਸੁਰੱਖਿਅਤ ਰੱਖਦੇ ਹਨ ਬਲਕਿ ਮਨੋਰੰਜਨ ਦਾ ਇੱਕ ਵਿਸ਼ਾਲ ਸਥਾਨ ਵੀ ਪ੍ਰਦਾਨ ਕਰਦੇ ਹਨ ਅਤੇ ਲੋਕ ਇਹਨਾਂ ਰਾਸ਼ਟਰੀ ਪਾਰਕਾਂ ਵਿੱਚ ਜਾਣ ਦਾ ਕੋਈ ਮੌਕਾ ਨਹੀਂ ਛੱਡਦੇ ਜੇਕਰ ਤੁਸੀਂ ਅੰਮ੍ਰਿਤਸਰ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਅੰਮ੍ਰਿਤਸਰ ਦੇ ਨੇੜੇ ਕੁਝ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਸਥਾਨ ਹਨ ਜਿਵੇਂ ਕਿ ਅਬੋਹਰ ਨੈਸ਼ਨਲ ਪਾਰਕ ਹਰੀਕੇ ਵੈਟਲੈਂਡ ਝੱਜਰ ਬਿਚੌਲੀ ਨੈਸ਼ਨਲ ਪਾਰਕ ਵੀਰ ਮੋਤੀ ਬਾਗ ਨੈਸ਼ਨਲ ਪਾਰਕ ਵੀਰ ਭਾਦਸੋਂ ਨੈਸ਼ਨਲ ਪਾਰਕ ਮਹਿੰਦਰਾ ਚਿੜੀਆ ਘਰ